ਮੈਂ ਅੱਜ ਤੱਕ ਕੋਈ ਵੀ ਕੂਕਿੰਗ ਕਲਾਸ ਜਿਹੜੀ ਬਾਹਰ ਜਾਂ ਵਰਕਸ਼ਾਪ ਮੇਰੇ ਵਲੋਂ ਕੋਈ ਨਹੀਂ ਲਗਾਈ ਗਈ ਹੈਗੀ ਜੋ ਵੀ ਮੈਂ ਕੂਕਿੰਗ ਦਾ ਸਿੱਖਿਆ ਹੈ ਉਹ ਅਪਣੇ ਘਰੋਂ ਹੀ ਆਪਣੀ ਮੰਮੀ ਤੋਂ ਸਿੱਖਿਆ ਆ ਪਰ ਜੇਕਰ ਮੈਨੂੰ ਮਤਲਬ ਟਾਈਮ ਮਿਲਦਾ ਹੈ ਤਾਂ ਮੈਂ ਅਪਣੇ ਯੂਟਿਊਬ ਤੋਂ ਸਿੱਖਣਾ ਚਾਹੁੰਦੀ ਹਾਂ ਨਵੇਂ ਨਵੇਂ ਆਚਾਰ ਪਾਉਣੇ ਅਤੇ ਨਵੇਂ ਨਵੇਂ ਮਰੱਬੇ ਬਣਾਉਣੇ ਜੋ ਕਿ ਸਿਹਤ ਲਈ ਬਹੁਤ ਹੀ ਵਧੀਆ ਹੁੰਦੇ ਨੇ ਜਿਹੜੀ ਕਿ ਸਾਡੀ ਸਿਹਤ ਨੂੰ ਹੈਲਦੀ ਰੱਖਦੇ ਨੇ ਉਹ ਸਿੱਖਣਾ ਚਾਹੁੰਦੀ ਹਾਂ ਜਾ ਉਹ ਸਿੱਖਦੀ ਰਹਿੰਦੀ ਹਾਂ